ਯੂਟਿਊਬ ਉੱਤੇ ਬਹੁਤ ਸਾਰੇ ਅਜਿਹੇ ਚੈਨਲ ਹੁੰਦੇ ਹਨ ਜਿੱਥੋਂ ਅਸੀਂ ਆਪਣੇ ਮਨੋਰੰਜਨ ਲਈ ਕੋਈ ਵੀ ਚੀਜ਼ ਦੇਖ ਸਕਦੇ ਹਾਂ ਮੈਂ ਜਦੋਂ ਵਿਹਲਾ ਹੁੰਦਾ ਹਾਂ ਤਾਂ ਯੂਟਿਊਬ ਦੇ ਵਿੱਚ ਕਈ ਸਾਰੀਆਂ ਵੀਡਿਓ ਅਤੇ ਵੈਬ ਸੀਰੀਜ਼ ਵਗੈਰਾ ਦੇਖਦਾ ਹਾਂ ਅਤੇ ਪੰਜਾਬੀ ਤੋਂ ਇਲਾਵਾ ਪਾਕਿਸਤਾਨੀ ਡਰਾਮਾ ਮੈਨੂੰ ਦੇਖਣਾ ਬਹੁਤ ਪਸੰਦ ਹੈ ਪਾਕਿਸਤਾਨੀ ਡਰਾਮੇ ਦੇ ਵਿੱਚ ਪਰੀਜ਼ਾਦ ਮੈਨੂੰ ਸਭ ਤੋਂ ਵਧੀਆ ਲੱਗਾ ਕਿਉਂਕਿ ਉਹਦੀ ਐਕਟਿੰਗ ਬਾਕਮਾਲ ਸੀ ਅਤੇ ਹਰ ਡਾਈਲੋਗ ਬਹੁਤ ਹੀ ਵਧੀਆ ਹੁੰਦਾ ਸੀ ਇਸ ਤੋਂ ਇਲਾਵਾ ਮੈਂ ਯੂਟਿਊਬ ਉੱਤੇ ਗਾਣੇ ਵੀ ਦੇਖਦਾ ਹਾਂ ਅਤੇ ਜਦੋਂ ਕੋਈ ਦਿੱਕਤ ਆ ਜਾਂਦੀ ਹੈ ਤਾਂ ਮੈਂ ਉਸ ਦੀ ਨਿਪਟਾਰੇ ਲਈ ਯੂਟਿਊਬ ਦੇ ਵਿੱਚ ਆਪਣੀ ਸਰਚ ਭਰ ਦਿੰਦਾ ਹਾਂ ਅਤੇ ਜੋ ਵੀ ਚੀਜ਼ ਵਿੱਚ ਮੈਨੂੰ ਔਖਿਆਈ ਪੇਸ਼ ਆਉਂਦੀ ਹੈ ਉਹ ਯੂਟਿਊਬ ਰਾਹੀਂ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ